ਹੈਲੋ ਮੈਂ ਗ੍ਰੀਨ ਹੋਟਲ ਵਿੱਚ ਫੋਨ ਕਰਿਆ ਕਰਦੀ ਹਾਂ ਮੈਂ ਤਹਾਨੂੰ ਕਹਿਣਾ ਚਾਹੁੰਦੀ ਹਾਂ ਕਿ ਮੈਂ ਤੁਹਾਡੇ ਹੋਟਲ ਤੋਂ ਥੋੜ੍ਹੀ ਦੇਰ ਪਹਿਲਾਂ ਫੋਨ ਕਰਕੇ ਇਹ ਔਰਡਰ ਪਾਇਆ ਸੀ ਮੈਂ ਦਾਲ ਮਖਣੀ ਨਾਨ੍ਹ ਪਨੀਰ ਸ਼ਾਹੀ ਪਨੀਰ ਮਲਾਈ ਕੋਫਤਾ ਔਡਰ ਕੀਤਾ ਸੀ ਅਤੇ ਤੁਹਾਡੀ ਸਰਵਿਸ ਬਹੁਤ ਅੱਛੀ ਹੈ ਪਰ ਗਲਤੀ ਨਾਲ ਮੈਂ ਸਿਰਫ ਇੱਕ ਸਵੀਟ ਡਿਸ਼ ਨਹੀਂ ਔਡਰ ਕਰ ਪਾਈ ਅਤੇ ਮੈਂ ਆਪਣੀ ਸਵੀਟ ਡਿਸ਼ ਵੀ ਤੁਹਾਨੂੰ ਔਡਰ ਕਰਨਾ ਚਾਹੁੰਦੀ ਹਾਂ ਅਤੇ ਉਹਦਾ ਵੀ ਤੁਸੀਂ ਬਿੱਲ ਵਿੱਚ ਹੀ ਐਡ ਕਰਕੇ ਮੈਨੂੰ ਭੇਜ ਦਿਓ ਮੈਂ ਸਵੀਟ ਡਿਸ਼ ਔਡਰ ਕਰਨਾ ਚਾਹੁੰਦੀ ਹਾਂ ਗੁਲਾਬ ਜਾਮੁਨ ਔਰ ਮੂੰਗ ਦਾਲ ਦਾ ਹਲਵਾ ਔਰ ਤੁਹਾਡੀ ਸਰਵਿਸ ਬਹੁਤ ਅੱਛੀ ਹੈ ਤੁਹਾਡਾ ਖਾਣਾ ਬਹੁਤ ਟੇਸਟੀ ਹੈ ਬਹੁਤ ਅੱਛਾ ਲੱਗਦਾ ਹੈ ਤੁਹਾਡੇ ਕੋਲੋਂ ਔਡਰ ਕਰਕੇ ਇੱਕ ਤਸੱਲੀ ਮਿਲਦੀ ਹੈ ਦਿਲ ਨੂੰ ਕਿ ਅਸੀਂ ਪੈਸੇ ਖਰਚਿਆ ਵੀ ਕਰਦੇ ਹਾਂ ਤਾਂ ਅਸੀਂ ਅੱਛੀ ਜਗ੍ਹਾ ਖਰਚਿਆ ਕਰਦੇ ਹਾਂ ਕੁਛ ਗਲਤ ਜਗ੍ਹਾ ਨਹੀਂ ਖਰਚਿਆ ਕਰਦੇ ਤੁਹਾਡੇ ਹੋਟਲ ਦਾ ਖਾਣਾ ਬਹੁਤ ਟੇਸਟੀ ਹੈ ਮੈਂ ਹਰ ਵਾਰੀ ਵੀ ਜਿੰਨੀ ਵਾਰੀ ਵੀ ਔਡਰ ਕਰਦੀ ਹਾਂ ਮੈਂ ਤੁਹਾਡੇ ਹੋਟਲ ਤੋਂ ਹੀ ਔਡਰ ਕਰਦੀ ਹਾਂ ਮੈਂ ਤੁਹਾਡੀ ਪੁਰਾਣੀ ਕਸਟਮਰ ਹਾਂ ਮੈਂ ਚਾਹੁੰਦੀ ਹਾਂ ਕਿ ਤੁਸੀਂ ਆਪਣੇ ਹੋਟਲ ਦਾ ਹੋਰ ਵੀ